ਸਤਿ ਸ਼੍ਰੀ ਅਕਾਲ ਮੇਰਾ ਨਾਮ ਵਾਸੁਦਾ ਹੈ ਅਤੇ ਮੈਂ ਜਿਲ੍ਹਾ ਪਠਾਨਕੋਟ ਦੀ ਰਹਿਣ ਵਾਲੀ ਰਹਿਣ ਵਾਲੀ ਹਾਂ ਅੱਜ ਮੈਂ ਤੁਹਾਨੂੰ ਟ੍ਰੈਕਿੰਗ ਸਾਈਟਸ ਦੇ ਬਾਰੇ ਦੱਸਣਾ ਚਾਹੁੰਦੀ ਹਾਂ ਜਿਵੇਂ ਕਿ ਮਤਲਬ ਭਾਰਤ ਵਿੱਚ ਬਹੁਤ ਸਾਰੀ ਟ੍ਰੈਕਿੰਗ ਵਾਲੀ ਜਗ੍ਹਾ ਹੈ ਪਰ ਜਿੱਥੇ ਮੈਂ ਐਕਸਪੀਰੀਐਂਸ ਕੀਤਾ ਹੈ ਮੈਂ ਉਸ ਬਾਰੇ ਤੁਹਾਨੂੰ ਅੱਜ ਥੋੜ੍ਹਾ ਬਹੁਤੀ ਜਾਣਕਾਰੀ ਦੇਣਾ ਚਾਹੁੰਦੀ ਹਾਂ ਜਿਵੇਂ ਕਿ ਮੈਂ ਧਰਮਸ਼ਾਲਾ ਵਿੱਚ ਟ੍ਰੈਕਿੰਗ ਕੀਤੀ ਸੀ ਅਤੇ ਉਸ ਵਿੱਚ ਆਪਾਂ ਆਪਣੇ ਗਾਈਡਰ ਨਾਲ ਗਏ ਸੀ ਉਹ ਦਸ ਜਾਂ ਬਾਰਾਂ ਕਿਲੋਮੀਟਰ ਦੀ ਟ੍ਰੈਕਿੰਗ ਹੁੰਦੀ ਹੈ ਉਸ ਦੌਰਾਨ ਆਪਾਂ ਬਹੁਤ ਸਾਰੇ ਚੀਜ਼ਾਂ ਦਾ ਐਕਸਪੀਰੀਐਂਸ ਕਰਦੇ ਹਾਂ ਅਤੇ ਹੋਰ ਉਸ ਨਾਲ ਇਹ ਹੁੰਦਾ ਕੇ ਸਾਨੂੰ ਕਾਫ਼ੀ ਕੁਛ ਮਤਲਬ ਜਗ੍ਹਾ ਬਾਰੇ ਪਤਾ ਲੱਗ ਜਾਂਦਾ ਹੋਰ ਆਲੇ ਦੁਆਲੇ ਬਾਰੇ ਪਤਾ ਲੱਗ ਜਾਂਦਾ ਔਰ ਹੁਣ ਆਪਾਂ ਗੱਲ ਕਰੀਏ ਟ੍ਰੈਕਿੰਗ ਦੌਰਾਨ ਅਸੀਂ ਵਾਤਾਵਰਨ ਬਾਰੇ ਕਿਵੇਂ ਸਫ਼ਾਈ ਰੱਖਦੇ ਹਾਂ ਆਪਾਂ ਅਤੇ ਮਤਲਬ ਵਾਤਾਵਰਨ ਅੱਜ ਕੱਲ੍ਹ ਦੁਨੀਆਂ ਬਹੁਤ ਅਡਵਾਂਸ ਹੋ ਗਈ ਹੈ ਕਿਉਂਕਿ ਸਭ ਨੂੰ ਪਤਾ ਜੇ ਕਿਤੇ ਗੰਦਗੀ ਹੋਵੇਗੀ ਤਾਂ ਓੱਥੇ ਅਤੇ ਗੰਦਗੀ ਹੋਵੇਗੀ ਅਤੇ ਬਿਮਾਰੀਆਂ ਅਤੇ ਫੈਲਣ ਗੀਆਂ ਅਤੇ ਲੋਕ ਅੱਜ ਕੱਲ੍ਹ ਮਤਲਬ ਆਪਣੇ ਆਪ ਨੂੰ ਬਿਮਾਰ ਨਹੀਂ ਹੋਣਾ ਦੇਣਾ ਚਾਹੁੰਦੇ ਪਹਿਲਾਂ ਵੀ ਟਾਈਮ 'ਤੇ ਸੀ ਪਰ ਉੰਨੀ ਚੀਜ਼ ਦਾ ਸਹੂਲਤ ਨਹੀਂ ਹੀ ਹੁਣ ਕਾਫ਼ੀ ਮਤਲਬ ਇੰਨਾ ਜ਼ਿਆਦਾ ਵਾਤਾਵਰਨ ਨੂੰ ਮਤਲਬ ਸਾਫ਼ ਰੱਖਣ ਦੀ ਕੋਸ਼ਿਸ਼ ਕਰਦੇ ਹੈ ਕਿ ਮਤਲਬ ਜਿੱਥੇ ਆਪਾਂ ਜਾਈਏ ਉੱਥੇ ਖੂਬਸੂਰਤ ਨਜ਼ਾਰਾ ਹੁਣ ਦੇਖੋ ਤੁਸੀਂ ਹੁਣ ਧਰਮਸ਼ਾਲਾ ਜਾਓਗੇ ਜੇ ਉੱਥੇ ਮਤਲਬ ਗੰਦਗੀ ਹੋਵੇਗੀ ਨਾ ਤੁਹਾਨੂੰ ਘੁੰਮਣ ਦਾ ਓੱਥੇ ਮਜ਼ਾ ਨਾ ਤੁਸੀਂ ਖਾ ਪਾਣਾ ਨਾ ਤੁਸੀਂ ਪੀ ਪਾਣਾ ਤੁਹਾਨੂੰ ਮਤਲਬ ਤੁਹਾਡਾ ਕੁਛ ਨਹੀਂ ਉੱਥੇ ਮਤਲਬ ਤੁਹਾਨੂੰ ਇੱਦਾਂ ਲੱਗਣਾ ਕਿ ਜਿੱਦਾਂ ਤੁਸੀਂ ਆਪਣੇ ਪੈਸੇ ਹੀ ਮਤਲਬ ਵਿਅਰਥ ਕਰ ਦਿੱਤੇ ਹੈ ਸੋ ਮੈਂ ਤਾਂ ਤੁਹਾਨੂੰ ਇਹ ਹੀ ਕਹਾਂਗੀ ਕਿ ਮੈਂ ਜੋ ਐਕਸਪੀਰੀਐਂਸ ਕੀਤੇ ਦਾ ਮੈਂ ਦੇਖਿਆ ਵਿੱਚ ਵਾਤਾਵਰਨ ਨੂੰ ਬਹੁਤ ਸਾਫ਼ ਰੱਖਦੇ ਹੈ ਅਤੇ ਹੌਲੀ ਹੌਲੀ ਮਤਲਬ ਇੱਦਾਂ ਹੋ ਜਾਵੇਗਾ ਕਿ ਮਤਲਬ ਹਰ ਜਗ੍ਹਾ ਹੀ ਵਾਤਾਵਰਨ ਸਾਫ਼ ਰੱਖਿਆ ਜਾਵੇਗਾ